ਸਾਡੇ ਘਰ ਦੇ ਆਲੇ ਦੁਆਲੇ ਇਲਾਕਿਆਂ ਨੂੰ ਮੈਂ ਹਰ ਵਕਤ ਸਾਫ ਦੇਖਣਾ ਚਾਹੁੰਦੀ ਹਾਂ ਮੇਰੀ ਕੋਸ਼ਿਸ਼ ਇਹੀ ਹੁੰਦੀ ਹੈ ਕਿ ਮੇਰੇ ਕਰਕੇ ਕਿਧਰੇ ਵੀ ਗੰਦ ਨਾ ਹੋਵੇ ਮੈਂ ਆਪਣੇ ਆਂਢ ਗੁਆਂਢ ਵੀ ਸਾਰਿਆਂ ਨੂੰ ਇਹ ਸਿੱਖਿਆ ਦਿੰਦੀ ਹਾਂ ਕਿ ਤੁਸੀਂ ਆਪਣਾ ਆਲਾ ਦੁਆਲਾ ਸਾਫ ਰੱਖੋ ਤਾਂ ਕਿ ਤੁਹਾਡੇ ਮੁਹੱਲੇ ਵਿੱਚ ਕੋਈ ਅੰਦਰ ਵੀ ਆਏ ਤਾਂ ਦੇਖ ਕੇ ਸਾਫ ਸੁਥਰਾ ਏਰੀਆ ਹੈਰਾਨ ਹੋ ਜਾਏ ਤਾਂ ਕਿ ਔਰ ਖੁਸ਼ ਹੋ ਜਾਏ ਤਾਂ ਕਿ ਸਾਰੇ ਕਹਿਣ ਕਿ ਤੁਹਾਡਾ ਮੁਹੱਲਾ ਬਹੁਤ ਸਾਫ ਸੁਥਰਾ ਹੈ ਇੱਕ ਮੁਹੱਲੇ ਤੋਂ ਸ਼ਹਿਰ ਸ਼ਹਿਰ ਤੋਂ ਦੇਸ਼ ਦੇਸ਼ ਤੋਂ ਦੁਨੀਆਂ ਸਭ ਸਾਫ ਸੁਥਰੀ ਹੁੰਦੀ ਜਾਂਦੀ ਹੈ ਸਾਰਾ ਸਾਫ ਮੁਹੱਲਾ ਸਾਡਾ ਭਾਰਤ ਵੀ ਤਰੱਕੀ ਦੀ ਰਾਹ 'ਤੇ ਚਲ ਸਕਦਾ ਹੈ ਮੈਂ ਆਪਣੇ ਘਰ ਦਾ ਕੂੜਾ ਵੀ ਸਭ ਇੱਕ ਜਗ੍ਹਾ 'ਤੇ ਇਕੱਠਾ ਕਰਕੇ ਰੱਖਦੀ ਹਾਂ ਤਾਂ ਕਿ ਉਹਦੀ ਵੀ ਖਾਦ ਬਣ ਸਕੇ ਔਰ ਉਹਨੂੰ ਅਸੀਂ ਯੂਜ ਕੀਤਾ ਜਾ ਸਕੇ